ਗਾਇਕੀ ਵਿੱਚ ਭਾਵਨਾਵਾਂ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਜੇਕਰ ਅਸੀਂ ਖੁਸ਼ ਹਾਂ ਤਾਂ ਅਸੀਂ ਉੱਦਾਂ ਦਾ ਹੀ ਗਾਣਾ ਪਸੰਦ ਕਰਦੇ ਹਾਂ ਜਿਹਦੇ ਵਿੱਚ ਸਾਡੀ ਖੁਸ਼ੀ ਸਾਡੇ ਗਾਇਨ ਵਿੱਚ ਝਲਕਦੀ ਹੈ ਜੇਕਰ ਅਸੀਂ ਉਦਾਸ ਹੁੰਦੇ ਹਾਂ ਤਾਂ ਸਾਨੂੰ ਗਾਇਨ ਵਿੱਚ ਵੀ ਜੋ ਗਾਣਾ ਹੈ ਉੱਦਾਂ ਦਾ ਹੀ ਗਾਉਣ ਨੂੰ ਦਿਲ ਕਰਦਾ ਹੈ ਜੇਕਰ ਅਸੀਂ ਬਹੁਤ ਜ਼ਿਆਦਾ ਮਸਤੀ ਦੇ ਮੂ ਮੂਡ ਵਿੱਚ ਹੁੰਦੇ ਹਾਂ ਤਾਂ ਸਾਨੂੰ ਗਾਉਣ ਵਿੱਚ ਵੀ ਉੱਦਾਂ ਦਾ ਹੀ ਗਾਣਾ ਪਸੰਦ ਆਉਂਦਾ ਹੈ ਤਾਂ ਕਰਕੇ ਸਾਡੀਆਂ ਭਾਵਨਾਵਾਂ ਗਾਇਨ ਵਿੱਚ ਵੀ ਝਲਕਦੀਆਂ ਹਨ